ਭਾਰਤ ਵਿੱਚ ਬਹੁਤ ਸਾਰੇ ਵਿਸ਼ੇ ਅਜਿਹੇ ਹਨ ਜਿਨ੍ਹਾਂ ਬਾਰੇ ਮੈਂ ਲਿਖਣਾ ਚਾਹੁੰਦਾ ਹਾਂ ਪਰ ਫਿਰ ਸ਼ਾਇਦ ਲਿਖਦਾ ਲਿਖਦਾ ਰਹਿ ਜਾਂਦਾ ਹਾਂ ਸੋਚਦਾ ਹਾਂ ਕਿ ਲਿਖਾ ਜਾਂ ਨਾ ਲਿਖਾ ਕਿਉਂਕਿ ਇਹ ਅਜਿਹੇ ਸੰਵੇਦਨਸ਼ੀਲ ਮੁੱਦੇ ਵਿਸ਼ੇ ਹਨ ਜਿਨ੍ਹਾਂ ਬਾਰੇ ਤੁਸੀਂ ਖਿਆਲ ਤਾਂ ਕਰ ਸਕਦੇ ਹੋ ਸੋਚ ਤਾਂ ਸਕਦੇ ਹੋ ਪਰ ਸ਼ਾਇਦ ਤੁਸੀਂ ਲਿਖ ਨਹੀਂ ਸਕਦੇ ਜੇ ਲਿਖ ਵੀ ਦਉਂਗੇ ਤਾਂ ਤੁਹਾਨੂੰ ਭਾਰਤ ਦੀ ਬਹੁਗਿਣਤੀ ਪਾਠਕਾਂ ਵੱਲੋਂ ਸਰੋਤਿਆਂ ਵੱਲੋਂ ਪ੍ਰਵਾਨ ਨਹੀਂ ਕਰਿਆ ਜਾਊਗਾ ਚੰਦ ਇੱਕ ਬੁੱਧੀਜੀਵੀ ਤਾਂ ਹੋ ਸਕਦਾ ਤੁਹਾਨੂੰ ਉਹਦੇ ਵਿੱਚ ਪ੍ਰਵਾਨ ਕਰਨ ਪਰ ਬਹੁਤ ਲੋਕ ਆ ਜਿਹੜੇ ਤੁਹਾਨੂੰ ਇਹਨਾਂ ਵਿਸ਼ਿਆਂ ਦੇ ਉੱਤੇ ਪ੍ਰਵਾਨ ਨਹੀਂ ਕਰਨਗੇ ਇਹਨਾਂ ਵਿੱਚੋਂ ਜੇ ਇੱਕ ਮੁੱਦੇ ਦੀ ਵੀ ਗੱਲ ਕਰੀਏ ਇੱਕ ਵਿਸ਼ੇ ਦੀ ਵੀ ਜੇ ਗੱਲ ਕਰੀਏ ਜਿਹਨੂੰ ਸ਼ੁਰੂ ਤੋਂ ਹੀ ਵਰਜਿਤ ਮੰਨਿਆ ਗਿਆ ਰੱਖਿਆ ਗਿਆ ਅਤੇ ਜਿਹੜਾ ਮਨੁੱਖ ਦੀਆਂ ਮੁੱਢਲੀਆਂ ਲੋੜਾਂ ਦੇ ਵਿੱਚੋਂ ਹੈ ਜਿਹਦੇ ਬਿਨਾ ਮਨੁੱਖ ਦੀ ਜ਼ਿੰਦਗੀ ਦਾ ਗੁਜ਼ਰ ਬਸਰ ਮਨੁੱਖ ਦੀ ਪੀੜ੍ਹੀ ਨੂੰ ਅੱਗੇ ਵਧਾਉਣ ਦੇ ਵਿੱਚ ਵੀ ਜਿਹਦਾ ਸਭ ਤੋਂ ਵੱਡਾ ਅਹਿਮ ਰੋਲ ਆ ਜਿਹਦੇ ਬਿਨਾ ਮਨੁੱਖ ਦਾ ਮਤਲਬ ਆਪਣਾ ਜੀਵਨ ਗੁਜ਼ਾਰਨਾ ਹੀ ਸੰਭਵ ਨਹੀਂ ਹੈ ਉਹ ਹੈ ਕਾਮ ਸੰਬੰਧ ਕਾਮ ਸੰਬੰਧਾਂ ਨੂੰ ਭੋਗਦਾ ਭਾਰਤ ਦੇ ਵਿੱਚ ਹਰ ਕੋਈ ਹੈ ਪਰ ਜੇ ਤੁਸੀਂ ਇਹਨਾਂ ਵਿਸ਼ਿਆਂ ਦੇ ਉੱਤੇ ਬੋਲੋਗੇ ਗੱਲਬਾਤ ਰੱਖੋਗੇ ਸੰਵਾਦ ਰਚਾਉਂਗੇ ਲਿਖੋਗੇ ਤਾਂ ਤੁਹਾਨੂੰ ਹੋਰ ਦ੍ਰਿਸ਼ਟੀ ਦੇ ਨਾਲ ਦੇਖਿਆ ਜਾਂਦਾ ਅਸੀਂ ਸੁਭਾਵਿਕ ਵੇਖਦੇ ਹਾਂ ਜਿਨ੍ਹਾਂ ਜਿਨ੍ਹਾਂ ਚਿੰਤਕਾਂ ਨੇ ਜਿਨ੍ਹਾਂ ਜਿਨ੍ਹਾਂ ਲੇਖਕਾਂ ਨੇ ਜਿਨ੍ਹਾਂ ਜਿਨ੍ਹਾਂ ਨਿਬੰਧਕਾਰਾਂ ਨੇ ਕਾਮ ਸੰਬੰਧਾਂ ਦੇ ਉੱਤੇ ਲਿਖਿਆ ਬੋਲਿਆ ਜਾਂ ਸੰਵਾਦ ਰਚਾਇਆ ਉਹਨਾਂ ਨੂੰ ਬਿਲਕੁਲ ਹੋਰ ਨਜ਼ਰ ਦੇ ਨਾਲ ਵੇਖਿਆ ਗਿਆ ਅਤੇ ਇਸ ਤੋਂ ਬਿਨਾ ਵੀ ਹੋਰ ਬਹੁਤ ਮੁੱਦੇ ਨੇ ਜਿਹੜੇ ਭਾਰਤ ਦੇ ਵਿੱਚ ਵਰਜਿਤ ਹਨ ਪਰ ਇਹ ਇੱਕ ਉਦਾਹਰਨ ਹੈ ਜਿਹੜੀ ਕਾਮ ਸੰਬੰਧਾਂ ਦੀ ਹੈ ਧੰਨਵਾਦ